ਸ਼ੁਰੂ ਤੋਂ ਹੀ ਮੇਰੇ ਮਨ ਪਸੰਦ ਕਲਾਕਾਰ ਮੇਰੇ ਸਕੂਲ ਦੇ ਪ੍ਰਿੰਸੀਪਲ ਜੋ ਕਿ ਕਾਰ ਟੀਚਰ ਵੀ ਹਨ ਉਹੀ ਰਹੇ ਹਨ ਅਤੇ ਮੈਂ ਉਹਨਾਂ ਤੋਂ ਅੱਜ ਤੱਕ ਬਹੁਤ ਕੁਝ ਸਿੱਖਿਆ ਹੈ ਸਾਰਾ ਕੁਝ ਮੈਨੂੰ ਸ਼ੁਰੂ ਤੋਂ ਉਹਨਾਂ ਨੇ ਹੀ ਸਿਖਾਇਆ ਹੈ ਉਹਨਾਂ ਨੂੰ ਸਾਨੂੰ ਦੱਸਿਆ ਹੈ ਕਿ ਕਿਵੇਂ ਪੇਂਟਿੰਗ ਕੀਤੀ ਜਾਂਦੀ ਹੈ ਕਿਵੇਂ ਇਹ ਪਹਿਲਾਂ ਕਿਵੇਂ ਹੁੰਦੀ ਸੀ ਅਤੇ ਹੁਣ ਕਿਵੇਂ ਹੋਣ ਲੱਗ ਪਈ ਆ ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਅਤੇ ਇਹ ਸਭ ਦੱਸਦੇ ਹੋਏ ਉਹਨਾਂ ਨੇ ਸਾਨੂੰ ਆਪਦੇ ਜੀਵਨ ਬਾਰੇ ਵੀ ਦੱਸਿਆ ਕਿ ਉਸ ਨੇ ਕਿਸ ਉਹਨਾਂ ਨੇ ਕਿਸ ਤਰ੍ਹਾਂ ਆਪਣੀਆਂ ਮੁਸ਼ਕਿਲਾਂ ਨਾਲ ਸਮਝੌਤਾ ਕੀਤਾ ਅਤੇ ਜੋ ਜੋ ਉਹਨਾ ਨੂੰ ਮੁਸ਼ਕਿਲਾਂ ਆਈਆਂ ਸੀਗੀਆਂ ਉਹਨਾਂ ਨੇ ਕਿਵੇਂ ਉਹਨਾਂ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਨੇ ਸਾਨੂੰ ਸਮਝਾਇਆ ਕਿ ਕਦੇ ਵੀ ਆਪਣੀਆਂ ਮੁਸ਼ਕਿਲਾਂ ਤੋਂ ਡਰਨਾ ਨਹੀਂ ਹੈ ਜਾਂ ਇਹਨਾਂ ਤੋਂ ਹਾਰਨਾ ਨਹੀਂ ਆ ਕਿਵੇਂ ਉਹਨਾਂ ਨੇ ਸਾਨੂੰ ਸਾਨੂੰ ਸਮਝਾਇਆ ਕਿ ਕਿਵੇਂ ਆਪ ਡੱਟ ਕੇ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਜਿਵੇਂ ਕਿ ਮੈਂ ਪਿੰਡ ਦੀ ਰਹਿਣ ਵਾਲੀ ਹਾਂ ਤਾਂ ਮੈਨੂੰ ਵੀ ਬਹੁਤ ਹੀ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਪ੍ਰਭਾਵਿਤ ਹੁੰਦੀ ਹਾਂ ਅਤੇ ਮੈਨੂੰ ਹੌਸਲਾ ਮਿਲਦਾ ਹੈ ਅਤੇ ਮੈਂ ਆਪਦੀਆਂ ਮੁਸ਼ਕਿਲਾਂ ਨਾਲ ਡਰ ਡੱਟ ਕੇ ਸਾਹਮਣਾ ਕਰਦੀ ਹਾਂ